ਵੈਸੇ ਤਾਂ ਸੈਲਾਨੀਆਂ ਦਾ ਸੈਲਾਨੀ ਜਿਹੜੇ ਆ ਇਸ ਮੰਦਰ ਨੂੰ ਦੇਖਣ ਲਈ ਆਉਂਦੇ ਰਹਿੰਦੇ ਆ ਅਤੇ ਉਹਨਾਂ ਦਾ ਬਹੁਤ ਈ ਪੋਜ਼ੀਟਿਵ ਐਕਸਪੀਰੀਐਂਸ ਰਿਹਾ ਪਰ ਕਈ ਵਾਰੀ ਉਹਨਾਂ ਨੂੰ ਮੁਸੀਬਤਾਂ ਦਾ ਕਾਫੀ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਜਿੱਦਾਂ ਕਿ ਉ ਮੰਦਰ ਵਿੱਚ ਰਹਿਣ ਲਈ ਜ਼ਿਆਦਾ ਜਗ੍ਹਾ ਨਹੀਂ ਹੈ ਅਤੇ ਉਹਨਾਂ ਨੂੰ ਸਟੇਅ ਕਰਨ ਲਈ ਦੂਰ ਦੂਰ ਜਾਣਾ ਪੈਂਦਾ ਅਤੇ ਕੋਈ ਵੀ ਰੂਮ ਜਲਦੀ ਵਿੱਚ ਮਤਲਬ ਅਵੇਲੇਬਲ ਨਹੀਂ ਹੁੰਦੇ ਅਤੇ ਫਿਰ ਉਹਨਾਂ ਨੂੰ ਹੋਰ ਵੀ ਕਈ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਜਿੱਦਾਂ ਕਿ ਜਿੱਦਾਂ ਕਿ ਉਹਨਾਂ ਨੂੰ ਲੈਂਗੁਏਜ਼ ਉਹਨਾਂ ਨੂੰ ਭਾਸ਼ਾ ਜਿਹੜੀ ਹੈ ਸਮਝ ਨਹੀਂ ਆਉਂਦੀ ਕਈ ਸਾਰੇ ਸੈਲਾਨੀ ਆ ਜਿਹੜੇ ਦੂਰ ਦੂਰ ਤੋਂ ਇਸ ਮੰਦਰ ਨੂੰ ਦੇਖਣ ਲਈ ਆਉਂਦੇ ਹੈ ਜਿੱਦਾਂ ਕਿ ਹਰਿਆਣਾ ਵਾਲੀ ਸਾਈਡ ਤੋਂ ਅਤੇ ਉਹਨਾਂ ਨੂੰ ਜਿਹੜੀ ਹੈ ਲੈਂਗੁਏਜ ਵਿੱਚ ਲੈਂਗੁਏਜ਼ ਸਮਝਣ ਵਿੱਚ ਬਹੁਤ ਹੀ ਦਿੱਕਤ ਆਉਂਦੀ ਹੈ ਅਤੇ ਮਤਲਬ ਖ ਖਾਣ ਖਾਣ ਲਈ ਉੱਥੇ ਮੈਸ ਵਗੈਰਾ ਵੀ ਨਹੀਂ ਹੈ ਉਹਨਾਂ ਨੂੰ ਖਾਣ ਪੀਣ ਲਈ ਜ਼ਿਆਦਾ ਦੂਰ ਦੂਰ ਜਾਣਾ ਪੈਂਦਾ ਅਤੇ ਜਿਹਦੇ ਕਾਰਨ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਆਉਂਦੀ ਹੈ ਔਰ ਆਵਾਜਾਈ ਦੀ ਵੀ ਬਹੁਤ ਸਾਰੀ ਪ੍ਰੋਬਲਮਸ ਆਉਂਦੀ ਹੈ ਜਿੱਦਾਂ ਕਿ ਬੱਸਿਸ ਵਗੈਰਾ ਨਹੀਂ ਲੱਗੀਆਂ ਹੋਈਆ ਉੱਥੇ ਆਉਣ ਜਾਣ ਲਈ ਧੰਨਵਾਦ